ਜਿਵੇਂ ਕਿ ਵੀਡੀਓ ਦਾ ਕੰਮ ਕਰਦੇ ਨੂੰ ਮੈਨੂੰ ਤਿੰਨ ਸਾਲ ਹੋ ਚੁੱਕੇ ਹਨ ਅਤੇ ਮੈਂ ਵਿਆਹਾਂ ਦਾ ਰੀਅਲ ਸਟੇਟ ਦਾ ਅਤੇ ਹੋਰ ਗਾਣਿਆਂ ਦਾ ਸ਼ੂਟ ਕਰਦਾ ਹਨ ਉਹਨਾਂ ਨੂੰ ਵਧੀਆ ਤਰੀਕੇ ਨਾਲ ਦਸ਼ ਦਰਸਾਉਣ ਲਈ ਕਈ ਤਰ੍ਹਾਂ ਦੇ ਚੀਜ਼ਾਂ ਜੋ ਹੈ ਕਾਪੀ 'ਤੇ ਲਿਖਣੀਆਂ ਪੈਂਦੀਆਂ ਹਨ ਅਤੇ ਹਰ ਇੱਕ ਸ਼ੋਟ ਨੂੰ ਕਾਪੀ 'ਤੇ ਲਿਖ ਕੇ ਫਿਰ ਉਹਦੀ ਲੋਕੇਸ਼ਨ ਚੂਜ਼ ਕੀਤੀ ਜਾਂਦੀ ਹੈ ਲੋਕੇਸ਼ਨ ਸਾਰਿਆਂ ਦੀਆਂ ਅਲੱਗ ਅਲੱਗ ਹੁੰਦੀਆਂ ਹਨ ਜੇ ਕੋਈ ਵਿਆਹ ਦਾ ਹੈ ਅਤੇ ਉਹਦੀ ਅਸੀਂ ਅਲੱਗ ਲੋਕੇਸ਼ਨ ਹੁੰਦੀ ਹੈ ਜੇ ਕੋਈ ਪ੍ਰੀ ਵੈਡਿੰਗ ਦਾ ਸ਼ੂਟ ਹੈ ਜੀ ਉਹਦੀ ਕੋਈ ਅਲੱਗ ਲੋਕੇਸ਼ਨ ਡਿਸਾਈਡ ਕਰਨੀ ਪੈਂਦੀ ਹੈ ਇੱਦਾਂ ਹੀ ਜਿਵੇਂ ਰੀਅਲ ਸਟੇਟ ਦਾ ਕੰਮ ਹੈ ਜੀ ਰੀਅਲ ਸਟੇਟ 'ਚ ਆਪਾਂ ਨੇ ਸਾਰਪ ਸਭ ਕੁਛ ਜੋ ਜੋ ਜਿਹੜੀਆਂ ਸੜਕਾਂ ਹੁੰਦੀਆਂ ਹਨ ਜਿਹੜੀਆਂ ਉਹਨਾਂ ਦੀਆਂ ਬੋਂਡਰੀਆਂ ਹਨ ਕਿੰਨੇ ਕਿਲਿਆਂ 'ਚ ਆਪਣਾ ਪ੍ਰੋਜੈਕਟ ਹੈ ਜਾਂ ਕਿੰਨੇ ਮਰਲੇ ਦੀ ਕੋਠੀ ਹੈ ਉਹ ਸਭ ਕੁਛ ਆਪਾਂ ਨੂੰ ਵੀਡੀਓ ਵਿੱਚ ਮੈਨਸ਼ਨ ਕਰਨਾ ਪੈਂਦਾ ਹੈ ਅਤੇ ਉਹਨੂੰ ਵਧੀਆ ਤਰੀਕੇ ਨਾਲ ਦਿਖਾਉਣ ਲਈ ਲਈ ਆਪਾਂ ਨੂੰ ਉਹਨਾਂ ਦੇ ਰੰਗਾਂ ਨਾਲ਼ ਸੋਫਟਵੇਅਰ ਵਿੱਚ ਉਹਦੇ ਰੰਗਾਂ ਨਾਲ ਖੇਲਣਾ ਪੈਂਦਾ ਹੈ ਅਤੇ ਉਹਨਾਂ ਨੂੰ ਸਹੀ ਕਰਨਾ ਪੈਂਦਾ ਹੈ ਅਤੇ ਆਪਾਂ ਜਦ ਸ਼ੂਟ ਕਰਦੇ ਹਾਂ ਕਰਦੇ ਹਨ ਉਹਨਾਂ ਨੂੰ ਆਪਾਂ ਰੋ ਫੋਰਮੈਟ ਵਿੱਚ ਸ਼ੂਟ ਕਰਦੇ ਹਨ ਤਾਂ ਕਿ ਆਪਾਂ ਨੂੰ ਉਹ ਜਿਹੜੀ ਵੀਡੀਓ ਹੈ ਉਹਦੀ ਡੈਫਟ ਕੁਆਲਿਟੀ ਮਿਲ ਸਕੇ ਜਿਹਨੂੰ ਆਪਾਂ ਬਾਅਦ 'ਚ ਸੋਫਟਵੇਅਰ ਵਿੱਚ ਜਾ ਕੇ ਉਹਦੇ ਰੰਗ ਬਦਲ ਸਕਦੇ ਹਨ ਉਹਦੇ ਨਾਲ਼ ਜੋ ਵੀਡੀਓ ਹੁੰਦੀ ਹੈ ਜੀ ਉਹ ਬਹੁਤ ਵਧੀਆ ਤਰੀਕੇ ਨਾਲ਼ ਦਿਖਦੀ ਹੈ ਅਤੇ ਉਹ ਸਾਡੇ ਜਿਹੜੇ ਕਲਾਇੰਟ ਹੁੰਦੇ ਹਨ ਜਿਵੇਂ ਕਿ ਵਿਆਹਾਂ ਵਾਲ਼ੇ ਰਿਸ਼ਤੇਦਾਰ ਜਿਹੜੇ ਸਾਰਿਆਂ ਦੀਆਂ ਫੋਟੋਆਂ ਕੈਪਚਰ ਕਰਦੇ ਹਨ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਉਹਨਾਂ ਦੇ ਅਕੋਡਿੰਗ ਹੀ ਅਸੀਂ ਜਿਹੜੀ ਵਿਆਹ ਵਾਲੀ ਐਲਬਮ ਵਗੈਰਾ ਹੁੰਦੀ ਹੈ ਉਹਨਾਂ ਨੂੰ ਅਸੀਂ ਬਣਾਉਦੇ ਹਾਂ ਅਤੇ ਜਿਵੇਂ ਵੀ ਉਹਨਾਂ ਦੀ ਡਿਮਾਂਡ ਹੁੰਦੀ ਹੈ ਜੀ ਉੱਨੀਆਂ ਅਸੀਂ ਫੋਟੋਆਂ ਲਾ ਦਿੰਦੇ ਹਨ ਉੱਦਾਂ ਦੀ ਅਸੀਂ ਵੀਡੀਓ ਕਰ ਦਿੰਦੇ ਕਰ ਦਿੰਦੇ